ਮੈਂ ਸਵੇਰੇ ਉੱਠਦਾ ਹਾਂ ਮੈਂ ਸਵੇਰੇ ਚਾਰ ਕੁ ਵਜੇ ਉੱਠਦਾਂ ਅਤੇ ਮੈਂ ਰਾਤ ਨੂੰ ਪਹਿਲਾਂ ਛੋਲੇ ਜੋ ਵੀ ਬਦਾਮ ਕਾਜੂ ਭਿਓਂ ਕੇ ਰੱਖਦਾ ਹਾਂ ਸਵੇਰੇ ਉੱਠ ਕੇ ਖਾਂਦ ਪਹਿਲਾਂ ਦੌੜਨ ਜਾਂਦਾ ਜੀ ਮੈਂ ਬੜੀ ਸਪੀਡ ਨਾਲ਼ ਭੱਜਦਾਂ ਜੀ ਤਿੰਨ ਜਾਂ ਚਾਰ ਕਿਲੋਮੀਟਰ ਭੱਜਦਾਂ ਜੀ ਮੈਂ ਬਹੁਤ ਭੱਜ ਭੁੱਜ ਕੇ ਡਬਲ ਲਗਾ ਕੇ ਅਤੇ ਕਸਰਤ ਕਰਦਾ ਹੈ ਜੀ ਡੰਡ ਡੁੰਡ ਮਾਰੀਦੀ ਹੈ ਜੀ ਅਤੇ ਹੋਰ ਵੀ ਕਰੀਦਾ ਪਾਣੀ ਪੂਣੀ ਪੀਈਦਾ ਗਰਮ ਕਰਕੇ ਦੁੱਧ ਪੀਈਦਾ ਜੀ ਜਿਹੜੇ ਕਾਜੂ ਬਦਾਮ ਆ ਜੀ ਉਹ ਭਿਓਂ ਕੇ ਸਵੇਰੇ ਖਾਂਦਾ ਜੀ ਮੈਂ ਰਨਿੰਗ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਲੱਗਦਾ ਸਵੇਰੇ ਉੱਠ ਕੇ ਜੀ ਜਦ ਭੱਜਦਾਂ ਜੀ ਮੈਂ ਸਾ ਸਾਂਹ ਲੈਣ ਨੂੰ ਵੀ ਬਹੁਤ ਵਧੀਆ ਲੱਗਦਾ ਜੀ ਜਦ ਬਾਹਰਲੀ ਹਵਾ ਲੈਂਦੇ ਠੰਡੀ ਠੰਡੀ ਜੀ ਅਤੇ ਬਹੁਤ ਵਧੀਆ ਮੈਨੂੰ ਲੱਗਦਾ ਜੀ ਮੈਂ ਰੋਜ਼ ਡੇਲੀ ਕਰਦਾਂ ਮੈਂ ਕਦੇ ਨਹੀਂ ਜੀ ਨਾਗਾ ਪਾਇਆ ਚਲੋ ਜੋ ਕਦੇ ਵੀ ਜੇ ਐਮਰਜੈਂਸੀ ਪੈ ਜਾਂਦੀ ਹੈ ਚਲੋ ਉਹ ਛੱਡਣਾ ਪੈ ਜਾਂਦਾ ਕੋਈ ਢਿੱਲਾ ਮੱਠਾ ਹੋ ਜਾਂਦਾ ਬੰਦਾ ਜੀ ਉਹਦੇ ਕਰਕੇ ਹੋ ਜਾਂਦਾ ਜੀ ਨਹੀਂ ਤਾਂ ਮੈਂ ਡੇਲੀ ਜਾਂਦਾ ਜੀ ਬਹੁਤ ਵਧੀਆ ਤਰੀਕੇ ਨਾਲ਼ ਕਰੀਦਾ ਜੀ ਕਦੇ ਵੀ ਨਾਗਾ ਨਹੀਂ ਪਿਆ ਮੈਨੂੰ ਜੀਅ ਲੱਗਦਾ ਜੀ ਮੇਰਾ ਸਵੇਰੇ ਬਹੁਤ ਭੱਜਣ ਨੂੰ ਜੀ